ਪੰਜਾਬ ਨੇ ਆਪਣੇ ਇਤਿਹਾਸ 'ਚ ਵੈਸੇ ਤਾਂ ਬਹੁਤ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ ਗੁਰੂਆਂ ਪੀਰਾਂ ਤੋਂ ਖਾਸਕਰ ਮੁਗਲਾਂ ਦਾ ਜੋ ਕਿ ਪੰਜਾਬ 'ਚ ਪੰਜਾਬ 'ਚ ਕੀ ਪੂਰੇ ਭਾਰਤ 'ਚ ਸਿਰਫ਼ ਔਰ ਸਿਰਫ਼ ਮੁਸਲਿਮ ਰਾਜ ਸਥਾਪਿਤ ਕਰਨਾ ਚਾਹੁੰਦੇ ਸੀ ਇਸ ਤੋਂ ਇਲਾਵਾ ਵੀ ਚਾਹੇ ਉਹ ਦਿੱਲੀ ਹੋਵੇ ਕਿਤੇ ਵੀ ਹੋਵੇ ਮਤਲਬ ਪੰਜਾਬੀਆਂ ਲਈ ਹਰ ਅੱਜ ਵੀ ਉਹ ਟਾਈਮ ਹੈ ਚੁਣੌਤੀਆਂ ਦਾ ਹੀ ਟਾਈਮ ਹੈ ਹਮੇਸ਼ਾਂ ਚੁਣੌਤੀਆਂ ਦਾ ਸਾਹਮਣਾ ਕੀਤਾ ਔਰ ਹਰ ਚੁਣੌਤੀ ਨੂੰ ਪਾਸ ਵੀ ਕੀਤਾ ਹੈ